ਡਾਂਸ ਰੀਲਾਂ ਸ਼ੋਟਸ ਸੋਸ਼ਲ ਮੀਡੀਆ 'ਤੇ ਦੇਖਦੇ ਜ਼ਰੂਰ ਹਾਂ ਲੇਕਿਨ ਉਹਨਾਂ ਨੂੰ ਕਦੀ ਸੀਰੀਅਸ ਨਹੀਂ ਲਿਆ ਸੋਸ਼ਲ ਮੀਡੀਆ 'ਤੇ ਬੇਸਿਕਲੀ ਮੈਂ ਜੋ ਹੈ ਉਹ ਸਿਰਫ ਫੇਸਬੁੱਕ ਚਲਾਉਂਦਾ ਫੇਸਬੁਕ 'ਤੇ ਵੀ ਕਾਫੀ ਜੋ ਡਾਂਸ ਰੀਲਾਂ ਸ਼ਾਰਟਸ ਵੇਖਣ ਨੂੰ ਮਿਲਦੇ ਹੈ ਲੇਕਿਨ ਉਹ ਵੀ ਮੈਂ ਉਦੋਂ ਦੇਖਦਾ ਹਾਂ ਜਦੋਂ ਥੋੜ੍ਹਾ ਬਹੁਤਾ ਟਾਈਮ ਦੀ ਵਿਹਲ ਹੁੰਦੀ ਹੈ ਜਾਂ ਆਪਣੇ ਆਪ ਨੂੰ ਟਾਈਮ ਦੇ ਰਹੇ ਹੁੰਦੇ ਹਾਂ ਅਦਰਵਾਈਜ਼ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮ 'ਚ ਬਿਜ਼ੀ ਹੁੰਦੇ ਹਾਂ ਉਸ ਤੋਂ ਬਾਅਦ ਆਪਣੀ ਫੈਮਲੀ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ ਬੱਚਿਆਂ ਨਾਲ ਬਿਜ਼ੀ ਹੋ ਜਾਂਦੇ ਲੇਕਿਨ ਫਿਰ ਵੀ ਜੋ ਪੰਜ ਸੱਤ ਮਿੰਟ ਦਸ ਮਿੰਟ ਅੱਧਾ ਘੰਟਾ ਪੰਦਰਾਂ ਵੀਹ ਮਿੰਟ ਜੋ ਮਿਲਦੇ ਆ ਉਹਦੇ ਵਿੱਚ ਜ਼ਰੂਰ ਫੇਸਬੁੱਕ ਨੂੰ ਸਕਰੋਲ ਕਰਦੇ ਹਾਂ ਬੜਾ ਕੁਛ ਉਹਦੇ ਵਿੱਚ ਜਨਰਲ ਨੋਲੇਜ ਦਾ ਵੀ ਹੁੰਦਾ ਅਤੇ ਹੋਰ ਵੀ ਕਾਫੀ ਕੁਛ ਹੁੰਦਾ ਲੇਕਿਨ ਕਾਫੀਆਂ 'ਚ ਡਾਂਸ ਰੀਲਸ ਹੁੰਦੀਆਂ ਸ਼ਾਰਟ ਹੁੰਦੇ ਆ ਉਸ ਤੋਂ ਪਹਿਲਾਂ ਇੱਕ ਟਿਕ ਟੋਕ ਨਾਂ ਦਾ ਇਕ ਐਪਲੀਕੇਸ਼ਨ ਆਇਆ ਲੇਕਿਨ ਮੈਂ ਉਹ ਕਦੇ ਆਪਣੇ ਫੋਨ ਦੇ ਵਿੱਚ ਇੰਸਟਾਲ ਨਹੀਂ ਕੀਤੀ ਲੇਕਿਨ ਲੋਕਾਂ ਤੋਂ ਬੜਾ ਸੁਣਦੇ ਹੁੰਦੇ ਸੀ ਉਸ ਐਪ ਬਾਰੇ ਕਿ ਇਹਨਾਂ ਨੇ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਨਚਾਰ ਬਣਾਇਆ ਹੋਇਆ ਇਹਨਾਂ ਜੋ ਐਪਸ ਨੇ ਟਿਕਟੋਕ ਹੋ ਗਈ ਜਾਂ ਸਨੈਪਚੈਟ ਹੋ ਗਈ ਇਸ ਤਰ੍ਹਾਂ ਦੇ ਜਿੱਥੋਂ ਤੱਕ ਗੱਲ ਕਰੀਏ ਕਿ ਮੇਰਾ ਕੋਈ ਪਸੰਦੀ ਦਾ ਡਾਂਸਰ ਕੋਈ ਨਹੀਂ ਹੈ ਫਿਲਹਾਲ ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਕਿਸੇ ਨੂੰ ਪਸੰਦ ਕਰੀਏ ਜਾਂ ਕਿਸੇ ਨੂੰ ਵਾਰ ਵਾਰ ਦੇਖੀ ਜਾਈਏ ਜਾਂ ਕਿਸੇ ਨੂੰ ਫੋਲੋ ਕਰੀਏ ਐਸਾ ਕੁਛ ਨਹੀਂ ਹੈ ਹਾਂ ਡਾਂਸ ਰੀਲਾਂ ਦੇਖਦੇ ਜ਼ਰੂਰ ਹਾਂ ਸ਼ੋਟਸ ਵਗੈਰਾ ਦੇਖਦੇ ਜ਼ਰੂਰ ਲੇਕਿਨ ਕਦੇ ਉਸਦੇ ਇੰਨੇ ਆਦੀ ਨਹੀਂ ਹੋਏ ਕਿ ਉਸ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ ਐਸਾ ਕੁਛ ਨਹੀਂ ਹੈ ਸੋਸ਼ਲ ਮੀਡੀਆ ਸਾਨੂੰ ਬੜਾ ਕੁਛ ਆਸ ਪਾਸ ਦੀ ਇਹ ਜੋ ਐਕਟੀਵਿਟੀਜ਼ ਉਹ ਦੇ ਬਾਰੇ ਜਾਣੂ ਵੀ ਕਰਵਾਉਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਜੋ ਸਾਨੂੰ ਮਿਸਗਾਈਡ ਵੀ ਕਰਦਾ ਸੋ ਫੋਨ ਜਾਂ ਸੋਸ਼ਲ ਮੀਡੀਆ ਓਨਾਂ ਕੁ ਯੂਜ ਕਰਦਾ ਕਿ ਜੋ ਆਪਣੀ ਸਿਹਤ ਲਈ ਅੱਛਾ ਹੋਵੇ ਆਪਣੀ ਜਾਣਕਾਰੀ ਲਈ ਅੱਛਾ ਹੋਵੇ

ਹੈ ਨਾ ਜੋ ਬਹੁਤੀ ਜਾਣਕਾਰੀ ਵੀ ਬੰਦੇ ਨੂੰ ਖਰਾਬ ਕਰਦੀ ਹੈ ਅਤੇ ਲਿਟਲ ਨੋਲੇਜ ਤਾਂ ਵੈਸੇ ਡੇਜਰਸ ਥਿੰਗ ਹੁੰਦੀ ਉਹ ਆਪਾਂ ਨੂੰ ਪਤਾ ਹੀ ਹੈ ਸੋ ਸਭ ਠੀਕ ਹੈ ਲੇਕਿਨ ਕੋਈ ਪਸੰਦੀਦਾ ਡਾਂਸਰ ਨਹੀਂ ਹੈ ਨਾ ਹੀ ਕੋਈ ਆਪਣਾ ਫੇਵਰੇਟ ਐਕਟਰ ਹੈ ਨਾ ਹੀ ਕੋਈ ਫੇਵਰਟ ਹੀਰੋ ਹੈ ਹਾਂ ਫੇਵਰੇਟ ਐਕਟਰ ਹੀਰੋ ਸਾਡੇ ਭਗਤ ਸਿੰਘ ਹੋਣੀ ਸਾਡੇ ਜੋ ਸਾਨੂੰ ਪੂਰਨੇ ਪਾ ਕੇ ਗਏ ਆ ਦੇਸ਼ ਲਈ ਸੇਵਾ ਲਈ ਸਮਾਜ ਸੇਵਾ ਲਈ ਉਹ ਸਾਡੇ ਹੀਰੋ ਨੇ ਉਹ ਸਾਡੇ ਪਸੰਦੀਦਾ ਐਕਟਰ ਲੋਕ ਨੇ ਹੀਰੋ ਨੇ ਸਾਡੇ ਉਹ ਦੇਸ਼ ਦੇ ਤਾਂ ਸੋਸ਼ਲ ਮੀਡੀਆ ਤੋਂ ਮੈਂ ਘੱਟ ਪ੍ਰਭਾਵਿਤ ਹਾਂ ਰੀਅਲ ਲਾਈਫ ਰੀਅਲ ਲਾਈਫ ਰੀਅਲ ਲਾਈਫ ਦੇ ਜੋ ਹੀਰੋਜ ਹੈ ਉਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੈ ਤਾਂ ਇਹ ਹੈ